ਜੀ ਹਾਂ ਮੈਨੂੰ ਪੰਜਾਬ ਤੋਂ ਇਲਾਵਾ ਵੀ ਕਿਸੇ ਦੂਸਰੀ ਜਗ੍ਹਾ ਦੇ ਉੱਪਰ ਜਾਣ ਦਾ ਮੌਕਾ ਮਿਲਿਆ ਸੀ ਅਤੇ ਉੱਥੋਂ ਦੀ ਭਾਸ਼ਾ ਬਿਲਕੁਲ ਹੀ ਵੱਖਰੀ ਸੀਗੀ ਅਤੇ ਉਹ ਜਗ੍ਹਾ ਸੀਗੀ ਹੈਦਰਾਬਾਦ ਆਂਧਰਾ ਪ੍ਰਦੇਸ਼ 'ਚ ਪੈਂਦਾ ਸੀ ਉਹ ਪਹਿਲਾਂ ਹੁਣ ਅੱਜ ਕੱਲ੍ਹ ਉਹ ਤੇਲੰਗਾਨਾ ਬਣ ਗਈ ਹੈ ਜਗ੍ਹਾ ਅਤੇ ਉੱਥੋਂ ਦੀ ਭਾਸ਼ਾ ਜਿਹੜੀ ਸੀ ਹੈਦਰਾਬਾਦ ਦੀ ਉਹ ਤੇਲਗੂ ਸੀ ਜਿਹੜੀ ਮੈਂ ਬਿਲਕੁਲ ਹੀ ਨਹੀਂ ਆਉਂਦੀ ਸੀ ਕਿਉਂਕਿ ਮੈਂ ਤਾਂ ਪੰਜਾਬੀ ਬੋਲਣ ਵਾਲਾ ਹਾਂ ਅਤੇ ਉੱਥੇ ਮੇਰੀ ਮਾਸੀ ਰਹਿੰਦੀ ਹੈ ਅਤੇ ਉਸਦਾ ਬੇਟਾ ਸੀ ਜਿਹੜਾ ਮੈਨੂੰ ਉਹ ਅਜਿਹੀ ਜਿਹੜੀ ਭਾਸ਼ਾ ਸੀ ਉੱਧਰ ਦੀ ਉਹ ਬੋਲ ਲੈਂਦਾ ਸੀਗਾ ਕਿਉਂਕਿ ਉਹ ਉੱਥੋਂ ਦਾ ਰਹਿਣ ਵਾਲਾ ਸੀਗਾ ਅਤੇ ਉੱਥੇ ਦਾ ਪੜ੍ਹਿਆ ਲਿਖਿਆ ਸੀ ਇਸ ਕਰਕੇ ਉਹਨੂੰ ਉੱਧਰ ਦੀ ਭਾਸ਼ਾ ਤੇਲਗੂ ਆਉਂਦੀ ਸੀਗੀ ਅਤੇ ਉਹ ਮੇਰੇ ਨਾਲ ਗਿਆ ਅਸੀਂ ਫਿਰ ਜਿੱਥੇ ਵੀ ਗਏ ਉੱਥੇ ਉਹ ਮੇਰਾ ਗਾਈਡ ਬਣ ਕੇ ਮੇਰਾ ਮੇਰੀ ਹੈਲਪ ਕਰਦਾ ਰਿਹਾ ਅਤੇ ਜਿੱਥੇ ਵੀ ਕਿਤੇ ਗੱਲਬਾਤ ਕਰਨ ਦਾ ਮੌਕਾ ਮਿਲਦਾ ਉਹ ਉਸ ਨੂੰ ਉਸ ਨੂੰ ਤੇਲਗੂ ਦੇ ਵਿੱਚ ਕਿਸੇ ਦੂਸਰੇ ਬੰਦੇ ਨੂੰ ਦੱਸਦਾ ਅਤੇ ਮੈਨੂੰ ਉਹ ਪੰਜਾਬੀ ਦੇ ਵਿੱਚ ਫਿਰ ਉਸ ਨੂੰ ਕਨਵਰਟ ਕਰਕੇ ਦੱਸਦਾ ਹੁੰਦਾ ਸੀਗਾ ਇਸ ਤਰ੍ਹਾਂ ਮੈਂ ਉੱਥੋਂ ਦੇ ਜਿਹੜੀ ਵੀ ਸੀਗੀ ਭਾਸ਼ਾ ਉਹਦੇ ਸੰਚਾਰ ਦਾ ਜਿਹੜਾ ਮਾਧਿਅਮ ਆਪਣੇ ਉਸ ਆਪਣੇ ਮਾਸੀ ਦੇ ਬੇਟੇ ਨੂੰ ਬਣਾਇਆ ਅਤੇ ਉਹ ਰਿਸ਼ਤੇ 'ਚ ਜਿਹੜਾ ਮੇਰਾ ਭਰਾ ਲੱਗਦਾ ਹੈ ਅਤੇ ਉਸ ਨੂੰ ਹੀ ਬਣਾਇਆ ਅਤੇ ਉਹ ਫਿਰ ਅੱਗੇ ਜਾ ਕੇ ਮੈਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਇੱਦਾਂ ਦੀਆਂ ਮੁਸ਼ਕਿਲਾਂ ਆਉਂਦੀਆਂ ਰਹੀਆਂ ਜਿੱਦਾਂ ਯਾਤਾਯਾਤ 'ਤੇ ਵੀ ਕਿਤੇ ਜਾਣਾ ਹੋਵੇ ਤਾਂ ਫਿਰ ਉੱਥੋਂ ਦੀ ਕਿਸੇ ਵੀ ਜਿਹੜੀ ਯਾਤਾਯਾਤ ਸਿਸਟਮ ਹੁੰਦਾ ਵਾ ਉਹਦੇ ਨਾਲ ਗੱਲਬਾਤ ਕਰਨ ਲਈ ਮੈਨੂੰ ਉਸ ਦਾ ਹੀ ਉਹਨੂੰ ਹੀ ਲੈਣਾ ਪੈਂਦਾ ਸੀ ਤੇ ਅਗਰ ਉਹ ਹੀ ਗੱਲਬਾਤ ਕਰਦਾ ਹੁੰਦਾ ਸੀਗਾ ਇਸ ਦੀ ਇਸ ਤਰ੍ਹਾਂ ਮੈਂ ਉੱਥੇ ਜਾ ਕੇ ਗਿਆ ਆਪਣੀ ਅਤੇ ਆਪਣੀ ਇਸ ਜਿਹੜੀ ਵੀ ਜਿਹੜੀ ਮੈਨੂੰ ਉਹ ਮੁਸ਼ਕਿਲ ਆਈ ਉਸ ਦਾ ਸਮਾਧਾਨ ਉਹਦੇ ਕੋਲੋਂ ਕਰਵਾਇਆ